ਪੰਜਾਬੀ ਲੋਕ ਆਪਣੇ ਸੱਭਿਆਚਾਰਕ ਪਰੰਪਰਾਵਾਂ ਨੂੰ ਮਨਾਉਣ ਅਤੇ ਸਨਮਾਨ ਦੇਣ ਲਈ ਆਪਣੀ ਭਾਸ਼ਾ ਪੰਜਾਬੀ ਦੀ ਹੀ ਵਰਤੋਂ ਕਰਦੇ ਹਨ ਪੰਜਾਬ ਵਿੱਚ ਵਿਆਹ ਸਮੇਂ ਲੋਕ ਗੀਤ ਗਾਉਂਦਿਆਂ ਉਹ ਆਪਣੀ ਭਾਸ਼ਾ ਪੰਜਾਬੀ ਦੀ ਹੀ ਵਰਤੋਂ ਕਰਦੇ ਹਨ ਜਿਵੇਂ ਕਿ ਜਦੋਂ ਕੋਈ ਵੀ ਲੋਕ ਗੀਤ ਗਾਉਂਦੇ ਹਨ ਤਾਂ ਉਹ ਪੰਜਾਬੀ 'ਚ ਗਾ ਕੇ ਹੀ ਲੋਕ ਗੀਤ ਦਾ ਆਨੰਦ ਮਾਣਦੇ ਹਨ